ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਆ ਰਹੀ ਹੈ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚਾਲ ਜੀ ਹਾਂਜੀ ਵਧੀਆ ਵਧੀਆ ਹੋਰ ਚਲੀ ਜਾਂਦਾ ਸੀਜ਼ਨ ਵਧੀਆ

ਹਾਂਜੀ ਮੈਂ ਨਾ ਅਸਲ 'ਚ ਸੂਟ ਸਵਾਉਣੇ ਸੀਗੇ ਤਿੰਨ ਹਾਂਜੀ ਮੈਨੂੰ ਨਾ ਅਸਲ 'ਚ ਉਧਰ ਮੇਰੇ ਨਾਨਕਿਆਂ 'ਚ ਵਿਆਹ ਸੀਗਾ ਅਤੇ ਜ਼ਰੂਰੀ ਚਾਹੀਦੇ ਸੀ ਅਤੇ ਸੂਟ ਨਾ ਮਤਲਬ ਮੈਨੂੰ ਅਗਲੇ ਹਫ਼ਤੇ ਚਾਹੀਦੇ ਤਿਆਰ ਪੂਰੇ ਸੋਮਵਾਰ ਤਿੰਨੋ ਦੇ ਤਿੰਨੋ ਹਾਂਜੀ ਨਹੀਂ ਅਸਲ 'ਚ ਨਾ ਉਹ ਟਾਈਮ ਦੇ ਟਾਈਮ ਹੀ ਪਤਾ ਲੱਗਾ ਨਾ ਵਿਆਹ ਦਾ ਤਾਂ ਕਰਕੇ ਫਿਰ ਇੱਕੋ ਦਮ ਮਤਲਬ ਹੋਵੇ ਤਿਆਰੀ ਵੀ ਸਾਡੀ ਕੋਈ ਨਹੀਂ ਸੀਗੀ ਹਜੇ ਮੈਂ ਕੱਲ ਹੀ ਸੂਟ ਲੈ ਕੇ ਆਈ ਅਤੇ ਤਾਂ ਕਰਕੇ ਫਿਰ ਮੈਂ ਤੁਹਾਨੂੰ ਅੱਜ ਹੀ ਮੈਂ ਕਿਹਾ ਚਲੋ ਫੋਨ ਲਾ ਦੇਵਾਂ ਫਿਰ ਵੀ ਟਾਈਮ ਵੇਸਟ ਕਾਹਤੋਂ ਕਰਨਾ ਹਾਂਜੀ ਹਾਂਜੀ ਸੋਮਵਾਰ ਮਤਲਬ ਮੈਂ ਮੰਗਲਵਾਰ ਹੈਗੇ ਆ ਫੰਕਸ਼ਨ ਪਰ ਸੋਮਵਾਰ ਮੈਂ ਜਾਣਾ ਹੈ ਸੋ ਪਹਿਲਾਂ ਹੀ ਲੈ ਕੇ ਜਾਉਂਗੀ ਹਾਂਜੀ ਚਲੋ ਤੁਸੀਂ ਇਸ ਤਰ੍ਹਾਂ ਕਰਿਓ ਦੋਵਾਂ ਸੂਟਾਂ ਦਾ ਚਲੋ ਜਿੰਨਾ ਹੋਏਗਾ ਲੈ ਲਿਓ ਇੱਕ ਦਾ ਲੈ ਲਿਓ ਡਬਲ ਕਿ ਨਹੀਂ ਇੱਕ ਜਿਹੜਾ ਹੈ ਉਹ ਸਿੰਪਲ ਹੈ ਅਤੇ ਦੋ ਲਾਈਨਿੰਗ ਵਾਲੇ ਹੈ ਹਾਂਜੀ ਹਾਂਜੀ ਉਹ ਮੈਂ ਨਾਲ ਲਿਆਂਦੀ ਹੋਈ ਆ ਫਿਰ ਉਹ ਜਦੋਂ ਵੀ ਹੋਏਗੀ ਨਾ ਉਦੋਂ ਮੈਂ ਦੱਸ ਦੂਗੀ ਹਾਂਜੀ ਹਾਂਜੀ ਹਾਂਜੀ ਠੀਕ ਕੋਈ ਨਹੀਂ ਜਿਸ ਤਰ੍ਹਾਂ ਵੀ ਹੋਇਆ ਨਾ ਮੈਨੂੰ ਦੱਸ ਦਿਓ ਹਾਂਜੀ ਅਤੇ ਇੱਕ ਮੈਂ ਨਾ ਕਹਿਣਾ ਸੀਗਾ ਕਿ ਪਿਛਲੀ ਵਾਰੀ ਆਪਾਂ ਜਿਹੜਾ ਸੂਟ ਸੀਤਾ ਸੀ ਨਾ ਮੇਰਾ ਰੈਡ ਕਲਰ ਦਾ ਹਾਂਜੀ ਉਹ ਨਾ ਥੋੜ੍ਹਾ ਲੂਜ਼ ਸੀਗਾ ਥੋੜ੍ਹੀ ਜਿਹੀ ਫੀਟਿੰਗ ਜਿਹੜੀ ਹੈ ਨਾ ਮਤਲਬ ਕਹਿ ਲਉ ਅੱਧੇ ਅੱਧੇ ਇੰਚ ਦੀ ਸੀਨ ਦੇ ਦਿਓ ਵਿੱਚ ਥੋੜ੍ਹੀ ਹੋਰ ਨਾ ਹਾਂਜੀ ਉਹ ਮੈਨੂੰ ਲੱਗਦਾ ਕੁਛ ਕੱਪੜਾ ਵੀ ਥੋੜ੍ਹਾ ਉਹੋ ਜਿਹਾ ਹੈ ਨਾ ਅਤੇ ਉਹ ਖੋੁਲ੍ਹ ਖੁੱਲ੍ਹ ਜਾਂਦਾ ਹੈ ਹਾਂਜੀ ਹਾਂਜੀ ਉਹੀ ਫਿਰ ਉਹ ਫੀਟਿੰਗ ਦਾ ਥੋੜ੍ਹਾ ਜਿਹਾ ਸੀਗਾ ਅਤੇ ਉਹ ਵੀ ਮੈਂ ਨਾਲ ਭੇਜੂਗੀ ਤੁਸੀਂ ਨਾਪ ਵੈਸੇ ਉਹਦਾ ਹੀ ਲੈ ਲਿਓ ਬਸ ਇੰਨਾ ਹੀ ਕਿ ਉਹਦੇ ਨਾਲੋਂ ਬਾਕੀ ਜਿਹੜੇ ਸੂਟ ਆ ਨਾ ਉਹ ਅੱਧੇ ਅੱਧੇ ਇੰਚ ਦਾ ਫਰਕ ਪਾ ਕੇ ਤੇ ਥੋੜ੍ਹੇ ਜਿਹੇ ਫੀਟਿੰਗ 'ਚ ਸੀਏ ਹਾਂ ਹਾਂਜੀ ਨਹੀਂ ਨਹੀਂ ਬਾਕੀ ਸਾਰਾ ਠੀਕ ਆ ਬਸ ਉਹੀ ਥੋੜ੍ਹਾ ਜਿਹਾ ਮਤਲਬ ਜਿਹੜਾ ਮੈਂ ਹੁਣ ਭੇਜੂਗੀ ਨਾ ਨਾਪ ਵਜੋਂ ਰੈਡ ਕਲਰ ਦਾ ਜਿਹੜਾ ਹੈ ਉਹਦਾ ਥੋੜ੍ਹਾ ਜਿਹਾ ਦੇਖ ਲਿਓ ਉਹ ਮਾੜਾ ਮਾੜਾ ਉਹਦੇ ਨਾਲੋਂ ਟਾਈਟ ਰੱਖਣਾ ਬਾਕੀ ਸਾਰਾ ਲੈਂਥ ਹੋ ਗਿਆ ਜਾਂ ਬਾਹਾਂ ਹੋ ਗਈਆਂ ਬਾਕੀ ਸਾਰਾ ਸੇਮ ਹੀ ਹੈ ਹਾਂਜੀ ਹਾਂਜੀ ਠੀਕ ਆ ਓਕੇ